ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਤਕਨੀਕੀ ਯੁੱਗ ਦੇ ਵਿੱਚ ਬਹੁਤ ਹੀ ਬਦਲਾਅ ਆ ਗਿਆ ਹੈ ਸਾਡੇ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਬਾਕੀ ਕਿ ਹੋਰ ਸਾਰੀਆਂ ਸਿਟੀਜ਼ ਦੇ ਵਿੱਚ ਵੀ ਬਹੁਤ ਸਾਰਾ ਬਦਲਾਅ ਆ ਗਿਆ ਹੈ ਜੇ ਅਸੀਂ ਵਕਾ ਵਿਕਾਸਸ਼ੀਲ ਸੰਸਾਰ ਨੂੰ ਦੇਖੀਏ ਤਾਂ ਅੱਜ ਦੇ ਯੁੱਗ ਵਿੱ ਤਕਨੀਕੀ ਯੁੱਗ ਦੇ ਵਿੱਚ ਬਹੁਤ ਸਾਰੇ ਚੇਂਜਿਸ ਆ ਗਏ ਹਨ ਜਿੱਦਾਂ ਕਿ ਪੁਰਾਣੇ ਸਮੇਂ ਦੇ ਵਿੱਚ ਲੋਕੀਂ ਪਹਿਲਾਂ ਆਪਣੇ ਹੱਥਾਂ ਨਾਲ ਕੰਮ ਕਰਦੇ ਸੀਗੇ ਅਤੇ ਉਹਨਾਂ ਨੂੰ ਕੰਮ ਕਰਦੇ ਸਮੇਂ ਬਹੁਤ ਟੈਮ ਲੱਗ ਜਾਂਦਾ ਹੁੰਦਾ ਸੀਗਾ ਅਤੇ ਮਿਹਨਤ ਵੀ ਜ਼ਿਆਦਾ ਲਾਉਂਦੇ ਹੁੰਦੇ ਸੀ ਅਤੇ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਕੋਈ ਵੀ ਕੰਮ ਹੈਗਾ ਅਸੀਂ ਉਹਨੂੰ ਸੌਖੇ ਤਰੀਕੇ ਦੇ ਨਾਲ ਮਸ਼ੀਨ ਦੇ ਨਾਲ ਕਰ ਸਕਦੇ ਹਾਂ ਜਿਹਦੇ ਨਾਲ ਕਿ ਸਾਨੂੰ ਸਾਡੀ ਤਾਕਤ ਵੀ ਘੱਟ ਲੱਗਦੀ ਹੈਗੀ ਆ ਅਤੇ ਅਸੀਂ ਉਹ ਕੰਮ ਨੂੰ ਘੱਟ ਸਮੇਂ ਦੇ ਵਿੱਚ ਅਤੇ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਕੰਮ ਕਰ ਸਕਦੇ ਹੈਗੇ ਆ ਇਸ ਤਰ੍ਹਾਂ ਕਿ ਵਿਕਾਸਸ਼ੀਲ ਸੰਸਾਰ ਬਾ ਵਿੱਚ ਸਾਡਾ ਬਹੁਤ ਹੀ ਫਾਇਦਾ ਹੋਇਆ ਹੈਗਾ ਹੈ ਇਹਦੇ ਵਿੱਚ ਅਸੀਂ ਮਤਲਬ ਕਿ ਕੋਈ ਵੀ ਕੰਮ ਨੂੰ ਛੇਤੀ ਤੋਂ ਛੇਤੀ ਕਰ ਸਕਦੇ ਹੈਗੇ ਹਾਂ ਅਤੇ ਜਿੱਥੇ ਸਾਨੂੰ ਕੋਈ ਵੀ ਕੰਮ ਕਰਨ ਦੇ ਜ਼ਿਆਦਾ ਲੋਕਾਂ ਦੀ ਲੋੜ ਪੈਂਦੀ ਹੁੰਦੀ ਸੀਗੀ ਉੱਥੇ ਅਸੀਂ ਉਹ ਕੰਮ ਨੂੰ ਇੱਕ ਜਣਾ ਹੀ ਕਰ ਸਕਦਾ ਹੈਗਾ ਕਿਉਂਕਿ ਅਸੀਂ ਮਸ਼ੀਨ ਦਾ ਯੂਜ਼ ਕਰਦੇ ਹੁੰਦੇ ਹੈਗੇ ਹਾਂ ਉਹਦੇ ਵਿੱਚ ਧੰਨਵਾਦ